ਟੈਕਨੋਲੋਜੀ ਨੇ ਨਾ ਸਿਰਫ ਮੇਰੇ ਨਾ ਮੇਰੇ ਆਲੇ ਦੁਆਲੇ ਬਲਕਿ ਸਾਰੇ ਹੀ ਦੁਨੀਆ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ ਇਸ ਦੀ ਸਹਾਇਤਾ ਨਾਲ ਅਸੀਂ ਹਰ ਚੀਜ਼ ਆਸਾਨੀ ਨਾਲ ਕਰ ਸਕਦੇ ਹਾਂ ਜਿਵੇਂ ਘਰ ਬੈਠੇ ਹੀ ਅਸੀਂ ਆਪਣੇ ਸਮਾਰਟ ਫੋਨ ਜਾਂ ਦੇ ਜ਼ਰੀਏ ਇੰਟਰਨੈਟ ਦੇ ਸਹਾਇਤਾ ਨਾਲ ਔਨਲਾਈਨ ਚੀਜ਼ਾਂ ਮੰਗਵਾ ਸਕਦੇ ਹਾਂ ਖਰੀਦਦਾਰੀ ਕਰ ਸਕਦੇ ਹਾਂ ਟਿਕਟਾਂ ਬੁੱਕ ਕਰ ਸਕਦੇ ਹਾਂ ਭਾਵੇਂ ਉਹ ਰੇਲਵੇਜ਼ ਦੀਆਂ ਹੋਣ ਭਾਵੇਂ ਏਅਰਵੇਜ਼ ਦੀਆਂ ਹੋਣ ਭਾਵੇਂ ਬੱਸ ਦੀਆਂ ਭਾਵੇਂ ਕੈਬ ਦੀਆਂ ਕਿਸੇ ਵੀ ਚੀਜ਼ ਦੀਆਂ ਟਿਕਟਾਂ ਬੁੱਕ ਕਰ ਸਕਦੇ ਹਾਂ ਹੋਟਲ ਦੀ ਬੁਕਿੰਗ ਕਰ ਸਕਦੇ ਹਾਂ ਸਿਨੇਮਾ ਦੀ ਟਿਕਟਾਂ ਬੁੱਕ ਕਰ ਸਕਦੇ ਹਾਂ ਆਪਣੀ ਬੈਂਕਿੰਗ ਦੀ ਸਹੂਲਤਾਂ ਪ੍ਰਾਪਤ ਕਰ ਸਕਦੇ ਹਾਂ ਜਿਵੇਂ ਕਿ ਪੈਸੇ ਇੱਕ ਅਕਾਊਂਟ ਤੋਂ ਦੂਜੇ ਅਕਾਊਂਟ ਵਿੱਚ ਟ੍ਰਾਂਸਫਰ ਕਰਨਾ ਸਾਡੇ ਕੋਲ ਕਿੰਨੇ ਪੈਸੇ ਹਾਂ ਬੈਂਕ ਅਕਾਊਂਟ ਵਿੱਚ ਅਸੀਂ ਉਹ ਚੈੱਕ ਕਰ ਸਕਦੇ ਹਾਂ ਭੁਗਤਾਨ ਕਰ ਸਕਦੇ ਹਾਂ ਕਿਸੇ ਵੀ ਚੀਜ਼ ਦੀ ਜਾਣਕਾਰੀ ਛੋਟੀ ਤੋਂ ਛੋਟੀ ਸੂਈ ਤੋਂ ਲੈ ਕੇ ਐਰੋਪਲੇਨ ਤੱਕ ਅਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਕਿਸੇ ਵੀ ਚੀਜ਼ ਲਈ ਸਾਨੂੰ ਜਗਿਆਸਾ ਹੋਏ ਪਤਾ ਕਰਨ ਦੀ ਕਿ ਇਹ ਚੀਜ਼ ਕਿਸ ਤਰ੍ਹਾਂ ਹੈ ਅਸੀਂ ਗੂਗਲ ਦੀ ਸਹਾਇਤਾ ਨਾਲ ਉਸ ਚੀਜ਼ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹਾਂ ਆਪਣੀ ਪੜ੍ਹਾਈ ਦੇ ਵਿਸ਼ਿਆਂ ਬਾਰੇ ਜਾਣਕਾਰੀ ਲੈ ਸਕਦੇ ਹਾਂ ਅਤੇ ਹੋਰ ਵੀ ਕਈ ਚੀਜ਼ਾਂ ਦੀ ਜਾਣਕਾਰੀ ਅਸੀਂ ਪ੍ਰਾਪਤ ਕਰ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਦੀ ਸਹਾਇਤਾ ਨਾਲ ਇੱਕ ਦੂਜੇ ਦੇ ਟੱਚ ਵਿੱਚ ਰਹਿ ਸਕਦੇ ਹਾਂ ਦੂਰ ਦੜਾ ਦਰਾਡੇ ਥਾਵਾਂ 'ਤੇ ਜਿੱਥੇ ਸਾਡੇ ਰਿਸ਼ਤੇਦਾਰ ਹਨ ਅਸੀਂ ਉਹਨਾਂ ਨਾਲ ਫੇਸ ਟੂ ਫੇਸ ਗੱਲ ਕਰ ਸਕਦੇ ਹਾਂ ਅਸੀਂ ਉਹਨਾਂ ਦੇ ਆਲੇ ਦੁਆਲੇ ਨੂੰ ਵੀ ਵੇਖ ਸਕਦੇ ਹਾਂ ਵੀਡੀਓ ਕੋਲ ਦੇ ਜ਼ਰੀਏ ਇੰਟਰਨੈਟ ਦੀ ਸਹਾਇਤਾ ਨਾਲ ਵੀਡੀਓ ਕੋਲ ਦੇ ਜ਼ਰੀਏ ਅਸੀਂ ਉਹਨਾਂ ਦੇ ਚਿਹਰੇ ਦੇਖ ਸਕਦੇ ਹਾਂ ਉਹਨਾਂ ਦੇ ਘਰ ਬਾਰ ਜੇ ਉਹ ਸਾਨੂੰ ਆਪਣਾ ਘਰ ਦਿਖਾਉਣਾ ਚਾਹੁਣ ਉਹ ਦੇਖ ਸਕਦੇ ਹਾਂ ਜੇ ਕੋਈ ਘੁੰਮਣ ਗਿਆ ਹੈ ਉਹ ਦੁ ਆਪਣੇ ਆਲੇ ਦੁਆਲੇ ਦੇ ਨਜ਼ਾਰੇ ਉਹ ਸਾਨੂੰ ਵੀ ਵੀਡੀਓ ਕੋਲ ਦੇ ਜ਼ਰੀਏ ਦਿਖਾ ਸਕਦਾ ਹੈ ਅਸੀਂ ਉਹਨਾਂ ਨਾਲ ਗੱਲਾਂ ਕਰ ਸਕਦੇ ਹਾਂ ਹਰ ਚੀਜ਼ ਦੀ ਜਾਣਕਾਰੀ ਅੱਜ ਕੱਲ੍ਹ ਇੰਨੀਆਂ ਸਹੂਲਤਾਂ ਹੈ ਇੰਟਰਨੈਟ ਨੇ ਸਾਨੂੰ ਟੈਕਨੋਲੋਜੀ ਨੇ ਦੇ ਦਿੱਤੀਆਂ ਹਨ ਜਿਸਦੀ ਸਹਾਇਤਾ ਨਾਲ ਅਸੀਂ ਬਹੁਤ ਵਧੀਆ ਅਤੇ ਆਸਾਨ ਜ਼ਿੰਦਗੀ ਜੀਅ ਸਕਦੇ ਹਾਂ